ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਰਦਾਰ ਸਵੀਟ ਸ਼ੋਪ ਤੋਂ ਬੋਲਦੇ ਭਾਈ ਜੀ ਵਧੀਆ ਵਧੀਆ ਤੁਸੀਂ ਸੁਣਾਓ ਭਾਅ ਜੀ ਹੋਰ ਸਿਹਤਾਂ ਉਹ ਭਾਅ ਜੀ ਤੁਹਾਨੂੰ ਪਤਾ ਸੀਗਾ ਛੁੱਟੀਆਂ ਦਾ ਟਾਈਮ ਚੱਲਦਾ ਘੁੰਮਣ ਫਿਰਨ ਗਏ ਜੀ ਤਾਂ ਆਏ ਹੀ ਹਾਂ ਕੱਲ੍ਹ ਪਰਸੋਂ ਜਿਹੇ ਭਾਅ ਜੀ ਮੈਂ ਕਿਹਾ ਆਪਣੇ ਭਤੀਜੇ ਦਾ ਜਨਮ ਦਿਨ ਆ ਰਿਹਾ ਅਤੇ ਬਰਫੀ ਦਾ ਕੀ ਪ੍ਰਾਈਜ਼ ਚਲਦਾ ਆ ਅੱਛਾ ਜੀ ਆਪਣੇ ਗੁਲਾਬ ਜਾਮਣ ਅੱਛਾ ਜੀ ਆਪਣੇ ਸੌ ਕੁ ਬੰਦੇ ਦਾ ਅਰੇਜਮੈਂਟ ਕਰਨਾ ਆਪਾਂ ਅਤੇ ਸਮੋਸਿਆਂ ਦਾ ਕੀ ਪ੍ਰਾਈਜ਼ ਜੀ ਆਪਣੇ ਸੌ ਸਮੋਸਾ ਆਪਾਂ ਨੂੰ ਚਾਹੀਦਾ ਸੌ ਸਮੋਸਾ ਚਾਹੀਦਾ ਅੱਛਾ ਜੀ ਠੀਕ ਆ ਅਤੇ ਆਪਣੇ ਅੱਛ ਅੱਛਾ ਅੱਛਾ ਜੀ ਠੀਕ ਠੀਕ ਅਤੇ ਆਪਣੇ ਉਹ ਆਪਣੇ ਉਹਦਾ ਕੀ ਪ੍ਰਾਈਜ਼ ਚੱਲਦਾ ਆ ਜੀ ਕੀ ਪ੍ਰਾਈਜ਼ ਚਲਦਾ ਹੋਣਾ ਭਾਅ ਜੀ ਆਹ ਪਕੋੜੇ ਹੋ ਗਏ ਬਰੈਡ ਹੋ ਗਏ ਆਪਣੇ ਪਨੀਰ ਵਾਲੇ ਪਕੌੜੇ ਉਹਦਾ ਕੀ ਪ੍ਰਾਈਜ਼ ਚੱਲਦਾ ਆਪਣਾ ਸੌ ਕੁ ਸੌ ਇਕ ਸੌ ਦਸ ਕੁ ਬੰਦਿਆਂ ਦਾ ਅਰੇਂਜਮੈਂਟ ਹੈਗਾ ਜਿਹੜਾ ਥੱਲੇ ਬੇਸਮੈਂਟ ਤੁਹਾਡਾ ਉੱਥੇ ਆਪਾਂ ਕਰਨੀ ਪਾਲਟੀ ਹਾਂ ਹਾਂਜੀ ਹਾਂਜੀ ਥੱਲੇ ਹੋਲ 'ਚ ਕਰਨੀ ਪਾਲਟੀ ਆਪਣੇ ਆਹ ਮੂਰਲੇ ਹਫ਼ਤੇ ਹੀ ਆ ਮੁੰਡੇ ਦਾ ਜਨਮ ਦਿਨ ਭਤੀਜੇ ਦਾ ਨਹੀਂ ਨਹੀਂ ਅਗਲੇ ਹਫ਼ਤੇ ਆਹੀ ਆ ਪੰਜ ਛੇ ਤਰੀਕ ਜੁਲਾਈ ਦੀ ਆਹ ਛੇ ਤਰੀਕ ਨੂੰ ਸਵੇਰ ਨੂੰ ਦੇ ਸਵੇਰ ਨੂੰ ਨਾ ਬਾਰਾਂ ਵਜੇ ਜਿਹਦਾ ਆਪਾਂ ਫਿਰ ਕੇਕ ਕੱਟਣਾ ਥੱਲੇ ਸਾਰਾ ਕੁਝ ਆਪਣਾ ਥੱਲੇ ਅਰੇਜਮੈਂਟ ਚਾਹੀਦਾ ਆਪਾਂ ਨੂੰ ਪੂਰਾ ਹਾਂਜੀ ਇਹ ਪੂਰੇ ਬਾਰਾਂ ਵਜੇ ਆਪਾਂ ਨੂੰ ਐਨ ਓਕੇ ਰਿਪੋਰਟ ਚਾਹੀਦੀ ਮੁੰਡੇ ਇੱਥੇ ਲਿਆ ਕੇ ਕੇਕ ਕੱਟਣਾ ਆਪਣਾ ਦ ਦੱਸੋ ਵੀ ਕੀ ਆਪਣਾ ਪ੍ਰਾਈਜ ਆ ਕੀ ਹਿਸਾਬ ਕਿਤਾਬ ਆ ਆਪਣਾ ਤੁਹਾਡਾ ਆਪਣੇ ਸਾਰਾ ਕੁਝ ਸੌ ਬੰਦਿਆ ਇਕ ਸੌ ਦਸ ਕੁ ਬੰਦੇ ਦਾ ਅਰੇਂਜਮੈਂਟ ਚਾਹੀਦਾ ਆਪਾਂ ਨੂੰ ਅੱਛਾ ਜੀ ਅੱਛਾ ਜੀ ਠੀਕ ਹੈ ਚੱਲੋ ਕੋਈ ਗੱਲ ਨਹੀਂ ਮੈਂ ਨਾ ਮ ਘਰਦਿਆਂ ਨਾਲ ਡਿਸਕਸ ਕਰਕੇ ਤੁਹਾਨੂੰ ਹਾਂ ਡਿਸਕਸ ਕਰਕੇ ਮੈਂ ਹਾਂ ਮੈਂ ਤੁਹਾਨੂੰ ਦੱਸ ਦੂੰਗਾ ਡਿਸਕਸ ਕਰਕੇ ਘਰਦਿਆਂ ਨਾਲ ਕਿੱਦਾਂ ਬੇ ਕਹਿੰਦੇ ਘਰਦੇ ਫਿਰ ਉੱਦਾਂ ਆਪਾਂ ਕਰਾਂਗੇ ਠੀਕ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ